ਨੈਵੀਗੇਸ਼ਨ ਸਾਨੂੰ ਬਹੁਤ ਸਾਰੀਆਂ ਐਪਲੀਕੇਸ਼ਨਾਂ ਪ੍ਰਦਾਨ ਕਰਦਾ ਹੈ ਜਿਵੇਂ ਕਿ ਗੂਗਲ ਮੈਪਸ ਐਪਲ ਮੈਪਸ ਮੈਪਸ ਇਹਨਾਂ ਦੇ ਥਰੂ ਅਸੀਂ ਕਿਸੇ ਵੀ ਕਰੰਟ ਲੋਕੇਸ਼ਨ 'ਤੇ ਪੁੱਜ ਸਕਦੇ ਹਾਂ ਜਿਵੇਂ ਕਿ ਅਗਰ ਆਪਾਂ ਬਾਈਕ 'ਤੇ ਜਾਣਾ ਹੋਵੇ ਉਹ ਸਾਨੂੰ ਬਾਈਕ ਰਾਹੀਂ ਸੰਦੇਸ਼ ਭੇਜਦਾ ਹੈ ਕਿ ਲੋਕੇਸ਼ਨ ਦਿੰਦਾ ਹੈ ਕਿ ਆਪਾਂ ਉਸ ਸਥਾਨ 'ਤੇ ਈਜ਼ੀਲੀ ਤਰੀਕੇ ਨਾਲ ਪਹੁੰਚ ਸਕੀਏ ਅਗਰ ਆਪਾਂ ਕਾਰ ਦੇ ਥਰੂ ਜਾਂ ਬਾਈਕ ਬਾਏ ਬੱਸ ਦੇ ਥਰੂ ਜਾਣਾ ਹੋਏ ਤਾਂ ਸਾਨੂੰ ਉਹ ਉਸ ਤਰ੍ਹਾਂ ਹੀ ਸੰਦੇਸ਼ ਭੇਜਦਾ ਹੈ ਅਤੇ ਸਾਨੂੰ ਉਸ ਜਗ੍ਹਾ 'ਤੇ ਪਹੁੰਚਣ ਲਈ ਸਾਨੂੰ ਨਿਰਦੇਸ਼ ਭੇਜਦਾ ਹੈ ਤਰ੍ਹਾਂ ਬਹੁਤ ਹੀ ਸਾਰੀਆਂ ਅਗਰ ਆਪਾਂ ਘਰ ਬੈਠੇ ਹੀ ਇਹਨਾਂ ਦੇ ਅੱਜ ਕੱਲ੍ਹ ਟੈਕਨੋਲੋਜੀ ਜਿਹੜੀ ਆ ਬਹੁਤ ਵੱਧ ਗਈ ਹੈ ਇਹਨਾਂ ਦੇ ਥਰੂ ਅਸੀਂ ਘਰ ਬੈਠੇ ਹੀ ਕਿਸੇ ਵੀ ਹੋਟਲ ਦੀ ਬੁਕਿੰਗ ਕਰਵਾ ਸਕਦੇ ਹਾਂ ਅਤੇ ਨੈਵੀਗੇਸ਼ਨਾਂ ਲਈ ਉਹਨਾਂ ਲਈ ਪਲੈਨਿੰਗ ਜਿਹੜੀ ਉਹ ਘਰ ਤੋਂ ਹੀ ਕਰ ਸਕਦੇ ਹਾਂ ਕਿਸੇ ਵੀ ਹੋਟਲ ਦੀ ਬੁਕਿੰਗ ਘਰ ਬੈਠੇ ਹੀ ਕੀਤੀ ਜਾ ਸਕਦੀ ਹੈ ਅੱਜ ਕੱਲ੍ਹ ਟੈਕਨੋਲੋਜੀ ਦੇ ਇੰਨੇ ਸਾਰੇ ਮੈਪ ਵੱਧ ਗਏ ਹਨ ਜਿਵੇਂ ਕਿ ਐਪਲ ਮੈਪਸ ਦੇ ਰਾਹੀਂ ਇਹ ਲੋਕੇਸ਼ਨਾਂ ਨੂੰ ਸਾਨੂੰ ਅਸੀਂ ਕਰੰਟ ਲੋਕੇਸ਼ਨ 'ਤੇ ਇਹਨਾਂ ਦੇ ਰਾਹੀਂ ਪਹੁੰਚ ਸਕਦੇ ਹਾਂ ਥੈਂਕ ਯੂ